ਹਾਂਜੀ ਜਗਸੀਰ ਸਿੰਘ ਜੀ ਅੱਛਾ ਵੀਰ ਜੀ ਦੁਕਾਨ 'ਤੇ ਹੀ ਹੋ ਮੈਂ ਬਲਜਿੰਦਰ ਸਿੰਘ ਬੋਲਦਾ ਸੀ ਜੋਗੇ ਤੋਂ ਬਾਈ ਜੀ ਇੱਕ ਉਹ ਲੈਣੀ ਸੀ ਐਲ ਸੀ ਡੀ ਬੱਤੀ ਬੱਤੀ ਇੰਚੀ ਲੈਣੀ ਸੀ ਜੀ ਕਿਹੜੀ ਕੰਪਨੀ ਦੀ ਹੈ ਠੀਕ ਹੈ ਜੀ ਅੱਛਾ ਕਿੰਨੇ ਕੁ ਪੈਸਿਆਂ ਦੀ ਹੋਊਗੀ ਉਹ ਅੱਛਾ ਜੀ ਹਾਂਜੀ ਅੱਛਾ ਜੀ ਅਤੇ ਇਹ ਗਰੰਟੀ ਕਿੰਨੇ ਚਿਰ ਦੀ ਹੋਊ ਜੋਗੇ ਤੋਂ ਹੀ ਬੋਲਦੇ ਹਾਂ ਜੀ ਬਲਜਿੰਦਰ ਸਿੰਘ ਹਾਂਜੀ ਠੀਕ ਹੈ ਜੀ ਠੀਕ ਹੈ ਜੀ

ਹਾਂ ਅਸੀਂ ਤੁਹਾਡੀ ਦੁਕਾਨ 'ਤੇ ਆਵਾਂਗੇ ਇੱਕ ਵਾਰ ਰੇਟ ਵੀ ਟਰਾਈ ਮਾਰ ਕੇ ਜਾਵਾਂਗੇ ਅਤੇ ਉਹ ਚੈੱਕ ਵੀ ਕਰਕੇ ਜਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਅਤੇ ਠੀਕ ਹੈ ਜੀ ਠੀਕ ਹੈ ਜੀ

ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਓ ਓਕੇ ਬਾਈ ਜੀ ਓਕੇ